ਯੋਗਾ ਡੇਲੀ ਵਾਈਜ਼ ਕਰਨਾ ਚਾਹੀਦਾ ਹੈ ਕਿਉਂਕਿ ਯੋਗਾ ਕਰਨ ਨਾਲ ਇੱਕ ਬੰਦੇ ਦੀ ਸਾਰਾ ਦਿਨ ਦੀ ਚੁਸਤੀ ਫੁਰਤੀ ਐਕਟੀਵਿਟੀ ਬਣੀ ਰਹਿੰਦੀ ਹੈ ਅਤੇ ਉਸ ਨਾਲ ਤੁਹਾਨੂੰ ਆਪਣੇ ਸਰੀਰਿਕ ਦੀਆਂ ਬਿਮਾਰੀਆਂ ਵੀ ਤੋਂ ਵੀ ਕਾਫ਼ੀ ਰਾਹਤ ਮਿਲਦੀ ਹੈ ਅਤੇ ਇਹ ਯੋਗਾ ਇੱਕ ਡੇਲੀ ਰੂਟੀਨ ਵਾਈਜ਼ ਕਰਨਾ ਚਾਹੀਦਾ ਹੈ ਆਪਣੇ ਮਹੱਤਵਪੂਰਨ ਕੰਮਾਂ ਦੇ ਵਿੱਚੋਂ ਟਾਈਮ ਕੱਢ ਕੇ ਤੁਹਾਨੂੰ ਇੱਕ ਯੋਗਾ ਦੇ ਲਈ ਤੁਹਾਨੂੰ ਅੱਧਾ ਪੌਣਾ ਘੰਟਾ ਡੇਲੀ ਕੱਢਣਾ ਚਾਹੀਦਾ ਹੈ ਕਿਉਂਕਿ ਉਸ ਨਾਲ ਐਕਸਰਸਾਈਜ਼ ਕਰਨ ਨਾਲ ਤੁਹਾਡੇ ਤੁਹਾਡੀ ਤੁਹਾਡੇ ਸਾਰਾ ਦਿਨ ਦੀ ਥਕਾਵਟ ਦੂਰ ਹੁੰਦੀ ਹੈ ਇਸ ਕਰਕੇ ਤੁਹਾਡਾ ਯੋਗਾ ਕਾਫ਼ੀ ਮਹੱਤਵਪੂਰਨ ਮੰਨਿਆ ਗਿਆ ਹੈ ਯੋਗ ਨਾਲ ਤੁਹਾਡਾ ਖਾਣਾ ਪੀਣਾ ਖਾਧਾ ਪੀਤਾ ਸਭ ਹਜ਼ਮ ਹੋ ਜਾਂਦਾ ਹੈ ਅਤੇ ਕਾਫ਼ੀ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ ਇਸ ਕਰਕੇ ਯੋਗਾ ਐਕਟੀਵਿਟੀ ਨੂੰ ਵੀ ਬੜਾ ਵਧਾਉਂਦਾ ਹੈ ਅਤੇ ਯੋਗੇ ਨਾਲ ਤੁਹਾਡੇ ਨਾਲ ਬਿਮਾਰੀਆਂ ਤੋਂ ਵੀ ਕਾਫ਼ੀ ਰਾਹਤ ਮਿਲਦੀ ਹੈ ਤੁਆ ਯੋਗਾ ਕਰਨ ਨਾਲ ਯੋਗਾ ਦੇ ਕਰਨ ਲਈ ਤੁਹਾਨੂੰ ਆਪਣੇ ਕੀਮਤੀ ਟਾਈਮ ਦੇ ਵਿੱਚੋਂ ਡੇਲੀ ਵਾਈਸ ਕੁਛ ਨਾ ਕੁਛ ਟਾਈਮ ਕੱਢ ਕੇ ਯੋਗਾ ਆਸਨ ਜਾਂ ਐਕਸਰਸਾਈਜ਼ ਦੇ ਰੂਪ ਵਿੱਚ ਕਰਨੀ ਚਾਹੀਦੀ ਹੈ ਜਿਸ ਨਾਲ ਤੁਹਾਡੇ ਸਾਰੇ ਸਰੀਰ ਦੀ ਫਿਟਨੈਸ ਰਹਿੰਦੀ ਹੈ